ਹੈਲੋ ਸੁਨੀਤਾ ਕਿਵੇਂ ਹੈਂ ਅ ਸੁਨੀਤਾ ਮੈਂ ਅਰਸ਼ ਬੋਲਦਾ ਤੇਰੇ ਨਾਲ ਪੜ੍ਹਿਆ ਸੀਗਾ ਮੈਂ ਦੇ ਵਿੱਚ ਆਪਾਂ ਪੜ੍ਹਦੇ ਸੀ ਦੋਨੇ ਇਕੱਠੇ ਯਾਦ ਹੈ ਹਾਂ ਹਾਂ ਹਾਂ ਹਾਂ ਹਾਂ ਵਧੀਆ ਵਧੀਆ ਮੈਂ ਤਾਂ ਤੈਨੂੰ ਕੋਲ ਇਸ ਕਰਕੇ ਕੀਤੀ ਸੀ ਅ ਤੂੰ ਹੁਣ ਬਠਿੰਡੇ 'ਚ ਹੀ ਰਹਿ ਰਹੀ ਹੈ ਨਾ ਅੱਛਾ ਅੱਛਾ ਉਹੀ ਉਸੇ ਬਾਰੇ ਮੈਂ ਗੱਲ ਕਰਨੀ ਸੀ ਐਕਚੁਲੀ ਨਾ ਮੈਂ ਪੜ੍ਹਦੇ ਪੜ੍ਹਦੇ ਵਿੱਚ ਮੈਂ ਆਪਣੇ ਆਹ ਫੂਡ ਵਲੋਗਿੰਗ ਬਾਰੇ ਸੋਚ ਰਿਹਾ ਸੀ ਅੱਜ ਕੱਲ੍ਹ ਟਰੈਂਡ ਬਹੁਤ ਚੱਲ ਰਿਹਾ ਫੂਡ ਵਲੋਗਿੰਗ ਦਾ ਤੈਨੂੰ ਪਤਾ ਹਾਂ ਮੈਂ ਵੀ ਯੂਟੀਊਬ 'ਤੇ ਕਾਫੀ ਦੇਖੀਆਂ ਬੜੇ ਬੜੇ ਫੇਮਸ ਹੋ ਰਹੇ ਆ ਯੂਟੀਊਬ 'ਤੇ ਅ ਫੂਡ ਬਲੋਗਰ ਵਾਲੇ ਤਾਂ ਮੈਂ ਚੈਨਲ ਸ਼ੁਰੂ ਕੀਤਾ ਸੀ ਆਪਣੇ ਨਾਮ ਤੋਂ ਅਰਸ਼ ਧੀਮਾਣ ਨਾ ਰਾਓ ਨਾਮ ਤੋਂ ਤਾਂ ਫਿਰ ਮੈਂ ਸੋਚਿਆ ਵੀ ਮੈਂ ਕੁਛ ਬਲੋਗਿੰਗ ਕਰਾਂ ਫੂਡ ਦੀ ਅਤੇ ਫਿਰ ਮੈਂ ਸੋਚਿਆ ਵੀ ਬਠਿੰਡੇ ਵਿੱਚ ਆਪਾਂ ਰਹਿ ਹੀ ਰਹੇ ਸੀਗੇ ਹੈ ਨਾ ਅਤੇ ਉੱਥੇ ਕਾਫੀ ਚੀਜ਼ਾਂ ਸੀਗੀਆਂ ਵਧੀਆ ਖਾਣ ਪੀਣ ਵਾਲੀ ਆਪਾਂ ਗਏ ਸੀ ਜਦੋਂ ਖਾਣ ਤੇ ਮੈਨੂੰ ਸਵਾਦ ਵੀ ਲੱਗਿਆ ਕਾਫੀ ਅਤੇ ਵਧੀਆ ਤਰੀਕੇ ਨਾਲ ਬਣਾਉਂਦੇ ਵੀ ਸੀ ਸਾਫ ਅਤੇ ਸ਼ੁੱਧ ਸੀਗਾ ਅਤੇ ਮੈਨੂੰ ਕੁਛ ਦੱਸ ਸਕਦੀ ਆਂ ਫਿਰ ਇਹਦੇ ਬਾਰੇ

ਹਾਂ

ਅੱਛਾ ਅੱਛਾ ਅਤੇ ਮੈਂ ਆਪਾਂ ਖਾਧਾ ਸੀ ਵਧੀਆ ਲੱਗਿਆ ਸੀ ਮੈਨੂੰ ਵੀ ਅਤੇ ਫਿਰ ਮੈਂ ਇੱਦਾਂ ਪੁੱਛ ਰਿਹਾ ਸੀਗਾ ਵੀ ਹੋਰ ਕੋਈ ਚੀਜ਼ ਹੈ ਜਿਹੜੀ ਹੋਰ ਵਧੀਆ ਹੋਏਗੀ ਮਤਲਬ ਵਲੋਗਿੰਗ ਦੇ ਵਿੱਚ ਕੰਮ ਆਵੇ ਜਿਹੜੀ ਟਰੈਂਡ ਵੀ ਕਰ ਸਕੇ ਅੱਜ ਦੇ ਟਾਈਮ ਦੇ ਵਿੱਚ ਮਤਲਬ ਜਿਵੇਂ ਹੁਣ ਚੱਲ ਰਹੀਆਂ ਵੀਡੀਓਜ਼

ਹਾਂ ਮੈਂ ਹਾਂ ਹਾਂ ਆਪਾਂ ਗਏ ਤਾਂ ਸੀ ਉੱਥੇ ਹੈ ਨਾ ਅਤੇ ਮਤਲਬ ਉਹ ਵੀ ਉਹਦੀ ਐਕਟਿੰਗ ਜੀ ਮਤਲਬ ਜਿਵੇਂ ਉਹ ਬਣਾਉਂਦਾ ਉਸ ਦਾ ਹਿਸਾਬ ਬਣਾਉਣ ਦਾ ਉਹ ਵੀ ਸੋਹਣਾ ਸੀ ਬਣਾਉਣ ਦਾ ਹੈ ਨਾ ਜਿੱਦਾਂ ਮਤਲਬ ਐਕਸ਼ਨ ਜਿਹੇ ਕਰਦਾ ਸੀ

ਅੱਛਾ ਤੇ ਮੈਂ ਇੱਦਾਂ ਸੋਚਦਾ ਸੀ ਕੋਈ ਇੱਦਾਂ ਦੀ ਚੀਜ਼ ਹੈਗੀ ਹੈ ਜਿਹੜੀ ਮਤਲਬ ਕੁਛ ਘੱਟ ਰੇਟ 'ਤੇ ਬਣਦੀ ਹੋਵੇ ਅਤੇ ਘੱਟ ਰੇਟ 'ਚ ਆਪਾਂ ਉਹਨੂੰ ਅੱਗੇ ਫਲੂ ਫੂਡ ਵਲੋਗਿੰਗ ਦੇ ਵਿੱਚ ਰਿਪ੍ਰਜ਼ੈਂਟ ਕਰ ਸਕੀਏ ਅਤੇ ਵਧੀਆ ਤਰੀਕਾ ਅਤੇ ਵਧੀਆ ਚੀਜ਼ ਹੋਵੇ ਕੋਈ ਅਲੱਗ ਜਿਹੀ ਕੋਈ ਹੈ ਇੱਦਾਂ ਦੀ

ਅੱਛਾ ਅੱਛਾ ਅੱਛਾ ਅਤੇ ਮੈਨੂੰ ਲੱਗਦਾ ਕਿ ਮੈਂ ਵਿਜ਼ਿਟ ਤਾਂ ਕਰੂੰਗਾ ਅਤੇ ਮੈਂ ਹਾਲੇ ਪਲੈਨ ਬਣਾਇਆ ਅਗਲੇ ਮਹੀਨੇ ਵੀ ਉਰੇ ਇੱਥੇ ਮਤਲਬ ਤੁਹਾਡੇ ਕੰਨੀ ਬਠਿੰਡੇ ਕੰਨੀ ਗੇੜਾ ਮਾਰ ਕੇ ਜਾਵਾਂ ਅਤੇ ਹੁਣ ਮੈਂ ਬਾਹਰ ਰਹਿ ਰਿਹਾ ਸੀ ਮੈਂ ਬਠਿੰਡੇ ਨਹੀਂ ਰਹਿ ਰਿਹਾ ਅਤੇ ਹਾਂ ਪਹਿਲਾਂ ਜਿੰਨਾ ਆਪਾਂ ਰਹੇ ਹਾਂ ਆਪਾਂ ਘੁੰਮੇ ਵੀ ਹਾਂ ਅਤੇ ਹੁਣ ਮੈਂ ਬਾਹਰ ਤੋਂ ਬਸ ਅ ਦਿਲ ਕਰਿਆ ਵੀ ਮੈਂ ਚੱਲ ਘੁੰਮ ਕੇ ਆਵਾਂ ਅਤੇ ਨਾਲੇ ਤੈਨੂੰ ਮਿਲ ਕੇ ਆਵਾਂ ਹੈ ਨਾ ਅਤੇ ਬਾਕੀ ਹੁਣ ਮੈਂ ਅਗਲੇ ਮਹੀਨੇ ਪੱਕਾ ਤੇਰੇ ਕੋਲ ਗੇੜਾ ਮਾਰੂੰਗਾ ਬਾਕੀ ਤੂੰ ਮੈਨੂੰ ਦੱਸ ਦੇਵੀਂ ਟਾਈਮ ਟੂਇਮ ਤੂੰ ਕਦ ਹੋਏਂਗੀ ਘਰੇ ਅਤੇ ਫਿਰ ਮੈਂ ਤੈਨ ਆਵਾਂ ਮਿਲਣ ਤੈਨੂੰ

ਹਾਂ ਹਾਂ ਠੀਕ ਠੀਕ ਹੈ ਚੱਲ ਚੰਗਾ ਫਿਰ ਓਕੇ ਫਿਰ ਮਿਲਦੇ ਮੈਂ ਵੀ ਜਾਣਾ ਸੀ ਹਲੇ ਬਾਹਰ ਹਾਂ ਓਕੇ ਓਕੇ